ਟੈਕਨੋਲੋਜੀ ਵਰਤੋਂ ਕਰਦੇ ਸਮੇਂ ਬਜ਼ੁਰਗਾਂ ਜਾਂ ਹੋਰ ਬ ਬੱਚਿਆਂ ਦੀ ਅੱਖਾਂ 'ਤੇ ਬਹੁਤ ਗਲਤ ਗਲਤ ਅਸਰ ਪੈਂਦਾ ਹੈ ਇਸ ਨਾਲ ਬੱਚਿਆਂ ਦੀ ਅੱਖਾਂ ਦੇ ਕਾਫ਼ੀ ਪ੍ਰਭਾਵਿਤ ਹੁੰਦੀਆਂ ਹਨ ਕਈਆਂ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਐਨਕਾਂ ਲੱਗ ਜਾਂਦੀਆਂ ਹਨ ਇਸ ਨਾਲ ਬੱਚਿਆਂ ਦੀ ਉਮਰ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਕਈ ਬੁੱਢ ਬੱਚੇ ਜਾਂ ਬੁਢਾਪੇ ਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਜਾਂਦੀ ਹੈ ਸਾਨੂੰ ਆਪਣੇ ਮੋਬਾਈਲ ਯੂਜ਼ ਜਾਂ ਹੋਰ ਟੈਕਨੋਲਜੀ ਦੀ ਵੱਧਦੇ ਕਾਰਨ ਸਾਨੂੰ ਮੋਬਾਈਲ ਯੂਜ ਘੱਟ ਕਰਨਾ ਚਾਹੀਦਾ ਹੈ ਅਤੇ ਇਸਦੇ ਇਹ ਸ ਇਹ ਸੰਭਵ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਮੋਬਾਇਲ ਹੋਰ ਟੈਕਨੋਲੋਜੀ ਜਿਹੜੀਆਂ ਵਧਦੀਆਂ ਟੈਕਨੋਲਜੀ ਉਹਨੂੰ ਛੱਡ ਕੇ ਆਪਣੇ ਘਰ ਦੇ ਆਪਣੇ ਹੱਥੀਂ ਕੰਮ ਕਈ ਕਈ ਹੱਥੀਂ ਕੰਮ ਕੋਈ ਕਰ ਲਵੇ ਬੰਦਾ ਕੰਮ ਕਰ ਲਵੇ ਹੱਥੀਂ ਕੰਮ ਕਰਨ ਨਾਲ ਸਾਡੀਆਂ ਅੱਖਾਂ 'ਤੇ ਵੀ ਰੋਸ਼ ਰਥਾ ਅੱਖਾਂ ਦੀ ਵੀ ਰੋਸ਼ਨੀ ਵੱਧਦੀ ਹੈ ਅਤੇ ਹੋਰ ਵੀ ਕੰਮ ਵਿੱਚ ਵਾਧਾ ਹੁੰਦਾ ਹੈ ਅਤੇ ਸਾਨੂੰ ਹਮੇਸ਼ਾ ਟੈਕਨੋਲੋਜੀ ਦੀ ਵਰਤੋਂ ਕਰਦੇ ਸਮੇਂ ਬਜ਼ੁਰਗਾਂ ਦੀਆਂ ਚੁਣੌਤੀਆਂ ਨੂੰ ਸਾਹਮਣਾ ਚੁਣੌਤੀਆਂ ਨੂੰ ਬਹੁਤ ਚੁਨੌ ਚੁਣੌਤੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਸਭ ਤੋਂ ਵੱਡਾ ਅਸਰ ਇਹ ਅੱਖਾਂ 'ਤੇ ਉਹ ਪਾਉਂਦਾ ਹੈ ਅਤੇ ਇਸ ਕਰਕੇ ਬੱਚਿਆਂ ਨੂੰ ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਅਤੇ ਜਾਂ ਇਹ ਛੋਟੀਆਂ ਛੋਟੀਆਂ ਐਨਕਾਂ ਲੱਗ ਜਾਂਦੀਆਂ ਨੇ ਇਹ ਖਰਚਾ ਵਧਾਉਂਦੀਆਂ ਹਨ ਅਤੇ ਬੱਚਿਆਂ ਦੀ ਵਰਤੋਂ ਦੀ ਵਰਤੋਂ ਬੱਚਿਆਂ ਦੀ ਅਗਾਂਹ ਬੱਚਿਆਂ ਦੇ ਭਵਿਸ਼ਅ ਵਿੱਚ ਅੱਗੇ ਵਾਧਾ ਨਹੀਂ ਵਧਾਉਂਦੀਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ